ਮੇਰਾ ਨਾਮ ਗੀਤਾਂਜਲੀ ਹੈ ਅਤੇ ਮੈਨੂੰ ਇੱਕ ਕਿਰਾਏ 'ਤੇ ਕੈਬ ਦੀ ਲੋੜ ਹੈ ਕਿਉਂਕਿ ਮੈਂ ਅਤੇ ਮੇਰਾ ਪਰਿਵਾਰ ਅਤੇ ਮੇਰੇ ਦੋਸਤ ਇੱਕ ਟੂਰ ਉੱਤੇ ਜਾਣ ਦੀ ਸਲਾਹ ਬਣਾ ਰਹੇ ਹਨ ਸਾਡਾ ਇਹ ਟੂਰ ਸ਼ਿਮਲਾ ਦਾ ਹੋਊਗਾ ਜਿਸ ਵਿੱਚ ਮੈਂ ਮੇਰੇ ਦੋਸਤ ਅਤੇ ਮੇਰੇ ਪਰਿਵਾਰ ਦੇ ਮੈਂਬਰ ਸ਼ਾਮਿਲ ਹਨ ਔਰ ਇਸ ਕੈਬ ਵਿੱਚ ਮੈਂ ਆਪ ਹੀ ਡਰਾਈਵ ਕਰਨਾ ਹੈ ਕਿਰਪਾ ਕਰਕੇ ਤੁਸੀਂ ਮੈਨੂੰ ਇਸ ਦਾ ਕਿਰਾਇਆ ਅਤੇ ਇਸ ਦੀਆਂ ਹੋਰ ਕੀਮਤਾਂ ਬਾਰੇ ਜਾਣਕਾਰੀ ਦੇ ਦਵੋ ਅਤੇ ਮੈਨੂੰ ਇਹ ਕੈਬ ਬਾਰ੍ਹਾਂ ਤਾਰੀਕ ਤੱਕਰ ਮੇਰੇ ਘਰ ਦੇ ਪਤੇ 'ਤੇ ਪਹੁੰਚਾ ਦਵੋ ਮੇਰਾ ਘਰ ਦਾ ਪਤਾ ਹੈ ਆਦਰਸ਼ ਨਗਰ ਰੋਪੜ ਕਿਰਪਾ ਕਰਕੇ ਤੁਸੀਂ ਟਾਈਮ 'ਤੇ ਮੈਨੂੰ ਇਹ ਸਾਰੀ ਚੀਜ਼ਾਂ ਦੀ ਜਾਣਕਾਰੀ ਦੇ ਦਿਓ ਤਾਂ ਜੋ ਤੁਸੀਂ ਇਹ ਕੈਬ ਸਮੇਂ ਸਿਰ ਮੇਰੇ ਘਰ ਦੇ ਐਡਰੈਸ 'ਤੇ ਪੁੱਜ ਜਾਵੇ ਤਾਂ ਜੋ ਅਸੀਂ ਟਾਈਮ 'ਤੇ ਆਪਣੇ ਸਫਰ 'ਤੇ ਜਾ ਸਕੀਏ ਧੰਨਵਾਦ